ਆਵਾਜਾਈ ਪ੍ਰਣਾਲੀ ਦਿਨ ਪ੍ਰਤੀ ਦਿਨ ਕਾਫੀ ਜੋ ਸੁਧਾਰ ਕਰ ਰਹੀ ਹੈ ਪਰ ਜਿਹੜੇ ਲੋਕ ਯਾਤਰਾ ਕਰਦੇ ਹਨ ਉਹਨਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਰਸ਼ ਵਧਣ ਕਾਰਨ ਭੀੜ ਵਧਣ ਕਾਰਨ ਕਾਫੀ ਆਵਾਜਾਈ ਠੱਪ ਹੋ ਜਾਂਦੀ ਹੈ ਜਿਹਦੇ ਕਰਕੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹਦੇ ਲਈ ਸਾਨੂੰ ਕਾਫੀ ਠੋਸ ਕਦਮ ਚੁੱਕਣ ਦੀ ਲੋੜ ਹੈ ਜਿਹਦੇ ਵਿੱਚ ਜੋ ਮਾਰਗਾਂ ਨੂੰ ਸੜਕਾਂ ਨੂੰ ਖੁੱਲ੍ਹਾ ਕੀਤਾ ਜਾਣਾ ਚਾਹੀਦਾ ਹੈ ਅਤੇ ਆਵਾਜਾਈ ਕੰਟਰੋਲ ਕਰਨ ਲਈ ਜੋ ਟਰੈਫਿਕ ਪੁਲਿਸ ਦੇ ਕਰਮਚਾਰੀ ਜਾਂ ਕੋਈ ਪ੍ਰਾਈਵੇਟ ਕਰਮਚਾਰੀ ਖੜ੍ਹਾ ਹੋਵੇ ਜੋ ਆਵਾਜਾਈ ਨੂੰ ਕੰਟਰੋਲ ਕਰੇ ਅਤੇ ਹੋਰ ਵੀ ਕਾਫੀ ਤਰ੍ਹਾਂ ਦੇ ਜੋ ਲੋਕ ਹੈ ਜੋ ਯਾਤਰਾ ਦੌਰਾਨ ਆਉਂਦੇ ਹਨ ਹੁੱਲੜਬਾਜੀ ਨਾ ਕਰਨ ਗੱਡੀਆਂ ਦੀ ਸਾਈਡ ਸਮੇਂ ਸਿਰ ਦੇਣ ਗੱਡੀਆਂ ਦੀ ਸਾਈਡ ਦੇਣ ਪਿੱਛੇ ਨਾ ਲੜਨ